ਪੰਜਾਬ ਦੇ ਵਿੱਚ ਸਭ ਤੋਂ ਵਧੀਆ ਜੋ ਮੈਨੂੰ ਲੱਗਦਾ ਗਾਇਕ ਹੈਗਾ ਆ ਸਤਿੰਦਰ ਸਰਤਾਜ ਹੈਗਾ ਆ ਉਹ ਸਭ ਤੋਂ ਵਧੀਆ ਸਤਿੰਦਰ ਸਰਤਾਜ ਦੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਉਹ ਕਾਫ਼ੀ ਐਜੂਕੇਟਿਡ ਆ ਪਿੱਛੇ ਉਹਦਾ ਇੱਕ ਮੈਂ ਇੰਟਰਵਿਊ ਦੇਖਿਆ ਸੀ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਉਹ ਇੱਕ ਕੋਲੇਜ ਦੇ ਵਿੱਚ ਪ੍ਰੋਫੈਸਰ ਸੀਗੇ ਜਿਵੇਂ ਮਿਊਜ਼ਿਕ ਦੇ ਪ੍ਰੋਫੈਸਰ ਸੀ ਉਹਨਾਂ ਨੇ ਪੀ ਐਚ ਡੀ ਵੀ ਕੀਤੀ ਵੀ ਮਿਊਜ਼ਿਕ ਦੀ ਤਾਂ ਉਹਨਾਂ ਨੇ ਜੋ ਗਾਣੇ ਗਾਏ ਆ ਉਹ ਵਰਲਡਵਾਈਡ ਫੇਮਸ ਨੇ ਅਤੇ ਕਈ ਥਾਵਾਂ ਦੇ ਵਿੱਚ ਉਹਨਾਂ ਨੂੰ ਪ੍ਰੋ ਪ੍ਰੋਗਰਾਮ ਕੀਤਾ ਜਾਂਦਾ ਹੈ ਕਿਤੇ ਸਪੇਸ਼ਲ ਆ ਕੇ ਪੰਜਾਬੀ ਸੱਭਿਆਚਾਰਕ ਗਾਣੇ ਗਾਓ ਅਤੇ ਉਹਨਾਂ ਦੇ ਜੋ ਸੋ ਗਾਣੇ ਵੀ ਨੇ ਅਤੇ ਉਹ ਬਹੁਤ ਜ਼ਿਆਦਾ ਅੱਛੇ ਨੇ ਇੱਦਾਂ ਦੇ ਉਹਨਾਂ ਦੇ ਵਿੱਚ ਕੋਈ ਵੀ ਇੱਦਾਂ ਦੇ ਵਰਡਸ ਜਾਂ ਕੋਈ ਇੱਦਾਂ ਦੇ ਲੜਾਈ ਵਾਲੇ ਗਾਣੇ ਨਹੀਂ ਗਾਏ ਜਾਂਦੇ ਜੋ ਮੈਨੂੰ ਬਹੁਤ ਪਰਸਨਲੀ ਅੱਛੇ ਲੱਗਦੇ ਨੇ ਅਤੇ ਸਤਿੰਦਰ ਸਰਤਾਜ ਦੇ ਬਹੁਤ ਹੀ ਸਾਰੇ ਸੋਂਗ ਸੂਫ਼ੀ ਸੋਂਗ ਜੋ ਬਹੁਤ ਅੱਛੇ ਨੇ ਜਿਵੇਂ ਕਿ ਉਹਨਾਂ ਦਾ ਪਹਿਰਾਵਾ ਜਿਹੜਾ ਹੈਗਾ ਬਹੁਤ ਅੱਛਾ ਆ ਸਿੰਪਲ ਅਤੇ ਸੋਬਰ ਆ ਜੋ ਸਾਡੇ ਪੰਜਾਬੀ ਕਲਚਰ ਨੂੰ ਦੱਸਦਾ ਆ ਅਤੇ ਜੋ ਉਹਨਾਂ ਦਾ ਖਾਣ ਪੀਣ ਹੈਗਾ ਉਹ ਵੀ ਬਹੁਤ ਸਿੰਪਲ ਨੇ ਪੰਜਾਬ ਦੇ ਵਿੱਚ ਮੋਸਟਲੀ ਖਾਣ ਪੀਣ ਦਾ ਬਹੁਤ ਰਿਵਾਜ਼ ਹੈ ਬਟ ਉਹਨਾਂ ਦਾ ਵੀ ਖਾਣਾ ਪੀਣਾ ਅੱਛਾ ਆ ਅਤੇ ਜੋ ਉਹਨਾਂ ਦਾ ਕਲਚਰ ਆ ਜੋ ਉਹਨੂੰ ਰੀਪ੍ਰਜ਼ੈਂਟ ਕਰਦੇ ਨੇ ਪੱਗੜੀ ਵ ਸ ਪੱਗ ਵਗੈਰਾ ਜਾਂ ਕੁੜਤਾ ਪਜਾਮਾ ਉਹ ਬਹੁਤ ਲਾਈਕ ਕਰਦੇ ਨੇ ਅਤੇ ਜੋ ਪੰਜਾਬੀ ਕਲਚਰ ਨੂੰ ਦੱਸਦਾ ਆ ਅਤੇ ਪੰਜਾਬੀ ਸਾਹਿਤ ਨੂੰ ਦੱਸਦਾ ਆ ਜੋ ਕਿ ਬਹੁਤ ਵੱਡੀ ਔਰ ਮਾਣ ਦੀ ਗੱਲ ਆ ਪੰਜਾਬ ਸਰਕਾਰ ਪੰਜਾਬ ਲਈ ਕਈ ਸਿੰਗਰ ਹੋਰ ਨੇ ਜਿੱਦਾਂ ਦਿਲਜੀਤ ਦੋਸਾਂਝ ਜੋ ਕਿ ਬਹੁਤ ਅੱਛੇ ਸਿੰਗਰ ਨੇ ਉਹਨਾਂ ਦਾ ਵੀ ਕਾਫ਼ੀ ਮਤਲਬ ਗਾਇਕੀ ਦੇ ਵਿੱਚ ਅੱਗੇ ਨਾਮ ਹੈਗਾ ਆ ਜੋ ਬਹੁਤ ਜ਼ਿਆਦਾ ਵਧੀਆ ਸਿੰਗਰ ਨੇ ਕਈ ਥਾਵਾਂ ਦੇ ਵਿੱਚ ਉਹਨਾਂ ਦੇ ਸ਼ੋਅਜ਼ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਸਪੈਸ਼ਲ ਬੁਲਾਇਆ ਜਾਂਦਾ ਆ ਉਹਨਾਂ ਦੀ ਪ੍ਰਫੋਰਮੈਂਸ ਵਾਸਤੇ ਪੰਜਾਬ ਕੀ ਬੋਲੀਵੁੱਡ ਦੇ ਵਿੱਚ ਔਰ ਕਈ ਸੌਂਗਸ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਆ ਸੌਂਗ ਪੰਜਾ ਬੋਲੀਵੁੱਡ ਦੇ ਕਈ ਕਲਾਕਾਰ ਜਾਂ ਕਈ ਸਿੰਗਰਸ ਨੇ ਜੋ ਉਹਨਾਂ ਨੂੰ ਬੁਲਾਉਂਦੇ ਨੇ ਉਹਨਾਂ ਨੇ ਇੱਕ ਨਵੀਂ ਫਿਲਮ ਵੀ ਬਣਾਈ ਸੀਗੀ ਜੋ ਕਾਫ਼ੀ ਫੇਮਸ ਹੋਈ ਅਤੇ ਉਹ ਵੀ ਬਹੁਤ ਅੱਛੇ ਸਿੰਗਰ ਨੇ ਪੰਜਾਬ ਦੇ ਵਿੱਚ ਸਿੰਗਰ ਬਹੁਤ ਨੇ ਪਰ ਜੋ ਮੇਰੇ ਆਪਣੇ ਪਰਸਨਲੀ ਫੇਮ ਵਧੀਆ ਲੱਗਦੇ ਜੋ ਮੈਨੂੰ ਉਹ ਮੈਨੂੰ ਇਹ ਦੋ ਸਿੰਗਰ ਵਧੀਆ ਲੱਗਦੇ